ਪੁਰਾਣੇ ਸਮੇਂ ਦੇ ਪੰਜਾਬੀ ਗਾਣਿਆਂ ਅਤੇ ਅੱਜ ਕੱਲ ਦੇ ਪੰਜਾਬੀ ਗਾਣਿਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜੇ ਅਸੀਂ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਪੁਰਾਣੇ ਟਾਈਮ ਦੇ ਵਿੱਚ ਗਾਣਿਆਂ ਦੇ ਵਿੱਚ ਸੱਭਿਆਚਾਰ ਨੂੰ ਦਿਖਾਇਆ ਜਾਂਦਾ ਸੀਗਾ ਅਤੇ ਲਹਿਜੇ ਵਾਲੇ ਸ਼ਬਦ ਵਰਤੇ ਜਾਂਦੇ ਹੁੰਦੇ ਸੀ ਜਿਹਦੇ ਕਰਕੇ ਸਾਰਾ ਪਰਿਵਾਰ ਮਿਲ ਜੁਲ ਕੇ ਗਾਣੇ ਸੁਣ ਸਕਦਾ ਹੁੰਦਾ ਸੀ ਪਰ ਜੇਕਰ ਅੱਜ ਆਪਾਂ ਗੱਲ ਕਰੀਏ ਅੱਜ ਦੇ ਗਾਣਿਆਂ ਦੀ ਤਾਂ ਅੱਜ ਦੇ ਗਾਣਿਆਂ ਦੇ ਵਿੱਚ ਸਿਰਫ ਨਸ਼ੇ ਹਥਿਆਰ ਅਤੇ ਲੜਾਈਆਂ ਨੂੰ ਦਿਖਾਇਆ ਜਾਂਦਾ ਜਿਹਦੇ ਕਰਕੇ ਜਿਹੜੇ ਲ ਅੱਜ ਕੱਲ ਦੇ ਨੌਜਵਾਨ ਨੇ ਉਹ ਨਸ਼ੇ ਵੱਲ ਜਾ ਰਹੇ ਨੇ ਅਤੇ ਲੜਾਈਆਂ ਪੜ੍ਹਾਈਆਂ ਦੇਖ ਕੇ ਉਸ ਤਰ੍ਹਾਂ ਲੜਦੇ ਨੇ ਅਤੇ ਅੱਜ ਕੱਲ ਦੇ ਜਿਹੜੇ ਗਾਣਿਆਂ ਦੀ ਸ਼ਬਦਾਵਲੀ ਆ ਉਹ ਵੀ ਬਹੁਤ ਵਧੀਆ ਨਹੀਂ ਹੈਗੀ ਗਾਣਿਆਂ ਦੇ ਵਿੱਚ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਹਨ ਜਿਹਦੇ ਵਿੱ ਜਿਹੜੇ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਵੀ ਨਹੀਂ ਸਕਦੇ ਅਤੇ ਜਿਹਦੇ ਕਰਕੇ ਹੁਣ ਅੱਜ ਕੱਲ ਦੇ ਪੰਜਾਬੀ ਗਾਣਿਆਂ ਦੇ ਵਿੱਚ ਸੁਧਾਰ ਲਿਆਉਣ ਦੀ ਬਹੁਤ ਲੋੜ ਆ ਜਿਵੇਂ ਕਿ ਸੂਫੀ ਕਾਵਿ ਹੋਇਆ ਇਹਨਾਂ ਸਾਰਿਆਂ ਨੂੰ ਗਾਣਿਆਂ ਦੇ ਵਿੱਚ ਲੈ ਕੇ ਆਉਣ ਦੀ ਲੋੜ ਆ ਤਾਂ ਕਿ ਗਾਣਿਆਂ ਦੀ ਸ਼ਬਦਾਵਲੀ ਵਧੀਆ ਬਣੇ ਅਤੇ ਇਹ ਸਾਰਿਆਂ ਨਾਲ ਬੈਠ ਕੇ ਸੁਣਨ ਦੇ ਯੋਗ ਹੋਣ